ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਜਿਵੇਂ ਕਿ ਮੈਂ ਕੁਛ ਦਿਨ ਲਈ ਘਰੋਂ ਬਾਹਰ ਚਲ ਜਾਂਦੀ ਹਾਂ ਤਾਂ ਮੈਂ ਆਪਣੇ ਪੌਦਿਆਂ ਦਾ ਧਿਆਨ ਆਪਣੀ ਮੰਮਾ ਨੂੰ ਜਾਂ ਆਪਣੀ ਭੈਣ ਨੂੰ ਜਾਂ ਆਪਣੇ ਭਰਾ ਨੂੰ ਕਹਿ ਕਹਿ ਕੇ ਜਾਂਦੀ ਹਾਂ ਅਤੇ ਜੇ ਮੇਰੇ ਘਰ ਵਿੱਚ ਕੋਈ ਵੀ ਨਹੀਂ ਹੁੰਦਾ ਤਾਂ ਮੈਂ ਆਪਣੇ ਨੇਬਰਸ ਨੂੰ ਕਹਿ ਕੇ ਜਾਂਦੀ ਹਾਂ ਉਹ ਮੇਰੇ ਪੌਦਿਆਂ ਨੂੰ ਪਾਣੀ ਲਗਾ ਦਿੰਦੇ ਹਨ ਅਤੇ ਮੇਰੇ ਨੇਬਰਸ ਵੀ ਬਹੁਤ ਅੱਛੇ ਹਨ ਅਤੇ ਉਹ ਮੇਰੇ ਪੌਦਿਆਂ ਦਾ ਪਾਣੀ ਬਹੁਤ ਧਿਆਨ ਰੱਖ ਦਿੰਦੇ ਹਨ ਮੇਰੇ ਜਾਣ ਤੋਂ ਵਗੈ ਬਾਅਦ ਜਾਣ ਤੋਂ ਬਾਅਦ ਅਤੇ ਜਿਵੇਂ ਕਿ ਮੈਂ ਕੁਝ ਦਿਨ ਲਈ ਘਰੋਂ ਬਾਹਰ ਚਲ ਜਾਂਦੀ ਹਾਂ ਤਾਂ ਮੇਰੀ ਮੰਮਾ ਉਹਨਾਂ ਦਾ ਧਿਆਨ ਰੱਖਦੇ ਹਨ ਜਿਵੇਂ ਕਦੀ ਕਦੀ ਮੇਰਾ ਪੇਪਰ ਹੁੰਦੇ ਹਨ ਅਤੇ ਮੈਨੂੰ ਪਛਾ ਪਠਾਨਕੋਟ ਤੋਂ ਅੰਮ੍ਰਿਤਸਰ ਮੈਨੂੰ ਪੇਪਰ ਦੇਣ ਆਉਣਾ ਪੈਂਦਾ ਹੈ ਇਹ ਜੂਨ ਜੁਲਾਈ ਦੇ ਮਹੀਨੇ ਚਲਦੇ ਹੁੰਦੇ ਆ ਅਤੇ ਉਸ ਦਿਨ ਔਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਪੌਦਿਆਂ ਨੂੰ ਦੋ ਟਾਈਮ ਪਾਣੀ ਦੀ ਲੋੜ ਪੈਂਦੀ ਹੈ ਅਤੇ ਸੁ ਸਵੇਰ ਦੇ ਟਾਈਮ ਫਿਰ ਮੇਰੇ ਮੰਮਾ ਪਾ ਜੇ ਮੈਂ ਪੇਪਰ ਦੇ ਕੇ ਸ਼ਾਮ ਨੂੰ ਆਉਂਦੀ ਹਾਂ ਤਾਂ ਫਿਰ ਸ਼ਾਮ ਨੂੰ ਮੈ ਪਾਣੀ ਪਾ ਦਿੰਦੀ ਹਾਂ ਜੇ ਮੇਰੇ ਘਰ ਵਿੱਚ ਕੋਈ ਵੀ ਨਹੀਂ ਹੁੰਦਾ ਫਿਰ ਮੇਰੇ ਗੁਆਂਢੀ ਪਾਣੀ ਪਾ ਦਿੰਦੇ ਹਨ ਉਹਨਾਂ ਨੂੰ ਮੈਂ ਕਹਿ ਕੇ ਜਾਂਦੀ ਹਾਂ ਉਹ ਬਹੁਤ ਚੰਗੇ ਹਨ ਅਤੇ ਮੈਂ ਉਹਨਾਂ ਦਾ ਧਿਆਨ ਆਪਣੇ ਮੰਮਾ ਨੂੰ ਪੌਦਿਆਂ ਦਾ ਧਿਆਨ ਆਪਣੀ ਮੰਮਾ ਨੂੰ ਕਹਿ ਕੇ ਜਾਂਦੀ ਹਾਂ ਉਹਨਾਂ ਵਿੱਚ ਖਾਦਾਂ ਪਾ ਕੇ ਉਹਨਾਂ ਵਿੱਚ ਗੋਡੀ ਵਗੈਰਾ ਕਰਦੇ ਹਨ ਅਤੇ ਉਹਨਾਂ ਦੀ ਮਤਲਬ ਕਿ ਸੜੇ ਪੱਤੇ ਵਗੈਰਾ ਲਗਾ ਲਾਹ ਦਿੰਦੇ ਹਨ ਕਿਉਂਕਿ ਸੜੇ ਪੱਤਿਆਂ ਨੂੰ ਮਤਲਬ ਕਿ ਝੜਨ ਦਾ ਵੀ ਮਤਲਬ ਕਿ ਪੌਦੇ ਨੂੰ ਵੱਖਰਾ ਟਾਈਮ ਚਾਹੀਦਾ ਹੁੰਦਾ ਹੈ ਇਸ ਕਰਕੇ ਮੰਮਾ ਆਪੇ ਸੜੇ ਪੱਤੇ ਵਗੈਰਾ ਲਾਹ ਦਿੰਦੇ ਆ ਉਹਨਾਂ ਨੂੰ ਗਾਰਡਨਿੰਗ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਉਹ ਮੇਰੇ ਨਾਲ ਗਾਰਡਨਿੰਗ ਅਸੀਂ ਦੋਨੇ ਇਕੱਠੇ ਕਰਦੇ ਹਾਂ ਅਤੇ ਮੇਰੀ ਮੰਮਾ ਵੀ ਨਾਲ ਕਰਦੇ ਹੈ ਅਤੇ ਮੇਰੀ ਭੈਣ ਵੀ ਉਹਨੂੰ ਵੀ ਗਾਰਡਨਿੰਗ ਦਾ ਸ਼ੌਕ ਹੈ ਉਹ ਵੀ ਮੇਰੇ ਨਾਲ ਗਾਰਡਨਿੰਗ ਵਿੱਚ ਹੈਲਪ ਕਰਦੀ ਹੈ